ਪੰਜਾਬ ਸਿੱਖਾਂ ਗੁਰੂਆਂ ਦੀ ਧਰਤੀ ਹੈ ਇਸ ਵਿੱਚ ਹਰ ਮੌਕੇ 'ਤੇ ਤਿਉਹਾਰ ਅਤੇ ਜਸ਼ਨ ਮਨਾਇਆ ਜਾਂਦਾ ਹੈ ਹਰ ਤਿਉਹਾਰ ਪਿੱਛੇ ਕੋਈ ਨਾ ਕੋਈ ਕਹਾਣੀ ਜੁੜੀ ਹੁੰਦੀ ਹੈ ਜਿਸਨੂੰ ਹਰ ਸਾਲ ਯਾਦ ਕਰਨ ਲਈ ਇਹ ਤਿਉਹਾਰ ਮਨਾਏ ਜਾਂਦੇ ਹਨ ਪੰਜਾਬ ਵਿੱਚ ਵਿਸਾਖੀ ਲੋਹੜੀ ਟਿੱਕਾ ਗੁਰਪੁਰਬ ਅਤੇ ਹੋਰ ਵੀ ਤਿਉਹਾਰ ਹਨ ਜੋ ਬਹੁਤ ਪ੍ਰਸਿੱਧ ਹਨ ਜਿਸ ਨੂੰ ਪੰਜਾਬੀ ਬਹੁਤ ਹੀ ਮਜ਼ੇ ਨਾਲ ਆਨੰਦ ਨਾਲ ਮਨਾਉਂਦੇ ਹਨ ਹਰ ਸਾਲ ਪੰਜਾਬੀਆਂ ਵਿੱਚ ਉਹਨਾਂ ਤਿਉਹਾਰਾਂ ਨੂੰ ਦੇ ਉਹਨਾਂ ਤਿਉਹਾਰਾਂ ਲਈ ਰੁਝਾਨ ਦੇਖਿਆ ਜਾ ਸਕਦਾ ਹੈ ਪੰਜਾਬੀ ਹਰ ਸਾਲ ਉਸ ਤਿਉਹਾਰ ਦੀ ਉਡੀਕ ਕਰਦੇ ਹਨ ਅਤੇ ਤਿਉਹਾਰ ਆਉਣ 'ਤੇ ਵੱਧ ਚੜ ਕੇ ਉਹਨੂੰ ਪੂਰੇ ਆਰਾ ਆਨੰਦ ਨਾਲ ਮਨਾਉਂਦੇ ਹਨ ਜਿਵੇਂ ਕਿ ਵਿਸਾਖੀ ਦਾ ਤਿਉਹਾਰ ਹੈ ਉਸ ਦਿਨ ਪੰਜਾਬ ਦੇ ਕਿਸਾਨ ਭਾਈ ਆਪਣੀਆਂ ਫਸਲਾਂ ਵੱਢਦੇ ਹਨ ਅਤੇ ਇਸ ਨੂੰ ਜਸ਼ਨ ਦੇ ਰੂਪ ਵਿੱਚ ਮਨਾਉਂਦੇ ਹਨ ਗੁਰਪੁਰਬ ਨੂੰ ਵੀ ਪੰਜਾਬ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਇਸ ਦਿਨ ਸਾਡੇ ਗੁਰੂ ਸਿੱਖੀ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਇਸ ਇਸ਼ਤਿਹਾਰ ਨੂੰ ਹਰ ਸਾਲ ਬਹੁਤ ਹੀ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਦਿਵਾਲੀ ਤੋਂ ਕੁਝ ਦਿਨਾਂ ਬਾਅਦ ਆਉਂਦਾ ਹੈ ਇਸ ਦਿਨ ਕਾਫ਼ੀ ਲੰਗਰ ਲੱਗਦੇ ਹਨ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਸ਼ੋਭਾ ਯਾਤਰਾ ਨਿਕਲਦੀ ਹੈ ਅਤੇ ਬਹੁਤ ਕੁਝ ਅਲੱਗ ਅਲੱਗ ਤਰੀਕੇ ਨਾਲ ਜਸ਼ਨ ਮਨਾਏ ਜਾਂਦੇ ਹਨ ਅਤੇ ਪੰਜਾਬ ਵਿੱਚ ਕਾਫ਼ੀ ਸਮਾਗਮ ਵੀ ਹੁੰਦੇ ਹਨ ਖੇਡਾਂ ਨੂੰ ਲੈ ਕੇ ਫਿਰ ਕਲਚਰ ਨੂੰ ਲੈ ਕੇ ਪੰਜਾਬ ਵਿੱਚ ਕਾਫ਼ੀ ਸਮਾਗਮ ਹੁੰਦੇ ਹਨ